ਮੈਂ ਆਪਣੇ ਘਰ ਵਿੱਚ ਕਈ ਤਰ੍ਹਾਂ ਦੇ ਪੌਦੇ ਲਗਾਏ ਹੋਏ ਹਨ ਜਿਨ੍ਹਾਂ ਵਿੱਚ ਕੁਝ ਅੰਦਰ ਰੱਖਣ ਵਾਲੇ ਹੁੰਦੇ ਹਨ ਅਤੇ ਕੁਝ ਬਾਹਰ ਰੱਖਣ ਵਾਲੇ ਹਨ ਇਹਨਾਂ ਪੌਦਿਆਂ ਤੋਂ ਮੈਂ ਹੋਰ ਪੌਦੇ ਤਿਆਰ ਕਰਦੀ ਹਾਂ ਜਿਵੇਂ ਪੀਸ ਲੀਲੀ ਬੋਤਲ ਪਾਮ ਸਪਾਈਡਰ ਪਲਾ ਪਾਂ ਪਲਾਂਟ ਇਹਨਾਂ ਤੋਂ ਇਹਨਾਂ ਦੀ ਕਟਿੰਗ ਨੂੰ ਕਰਕੇ ਮੈਂ ਹੋਰ ਪੌਦੇ ਤਿਆਰ ਕਰਦੀ ਹਾਂ ਜਿਸ ਤਰ੍ਹਾਂ ਕੰਘੀ ਪਾਮ ਆ ਇਸ ਦੇ ਵਿੱਚੋਂ ਕੀ ਆ ਛੋਟੇ ਛੋਟੇ ਬੇਬੀਜ਼ ਨਿਕਲਦੇ ਆ ਉਹਨਾਂ ਨੂੰ ਮੈਂ ਕੱਢ ਕੇ ਦੂਸਰੀ ਥਾਂ 'ਤੇ ਲਾ ਦਿੰਦੀ ਉਸ ਤੋਂ ਮੈਂ ਪੌਦੇ ਤਿਆਰ ਕਰਦੀ ਹਾਂ ਅਤੇ ਬਾਅਦ ਵਿੱਚ ਮੈਂ ਉਹਨਾਂ ਪੌਦਿਆਂ ਨੂੰ ਹੋਰ ਗਮਲਿਆਂ ਵਿੱਚ ਲਾ ਕੇ ਹੋਰ ਪੌਦੇ ਤਿਆਰ ਕਰ ਲੈਂਦੀ ਹਾਂ ਇਸ ਤਰ੍ਹਾਂ ਜਿਸ ਤਰ੍ਹਾਂ ਦਸੰਬਰ ਜਨਵਰੀ ਫਰਵਰੀ ਵਿੱਚ ਮੈਂ ਆਪਣੇ ਪੌਦਿਆਂ ਦੀ ਕਟਿੰਗ ਕਰਕੇ ਉਹਨਾਂ ਤੋਂ ਮੈਂ ਹੋਰ ਪੌਦੇ ਤਿਆਰ ਕਰਦੀ ਹਾਂ ਉਹਨਾਂ ਤੋਂ ਮੇਰੇ ਹੋਰ ਗੁਲਾਬ ਤਿਆਰ ਹੋ ਜਾਂਦੇ ਹਨ ਇਸ ਤਰ੍ਹਾਂ ਹੀ ਮੈਂ ਇਹ ਦੋ ਕਲਮਾਂ ਲੈ ਕੇ ਉਹਨਾਂ ਦੀ ਗ੍ਰਾਫਟਿੰਗ ਕਰਦੀ ਹਾਂ ਜੋ ਕਿ ਨਵੀਂ ਕਿਸਮ ਤਿਆਰ ਕਰ ਲਈਦੀ ਹੈ ਇਸ ਤਰ੍ਹਾਂ ਮੈਨੂੰ ਘਰ ਵਿੱਚ ਬੂਟੇ ਲਗਾਉਣ ਦਾ ਬਹੁਤ ਸ਼ੌਕ ਹੈ ਅਤੇ ਮੈਂ ਆਪਣੇ ਘਰ ਵਿੱਚ ਕਈ ਤਰ੍ਹਾਂ ਦੇ ਬੂਟੇ ਲਗਾਏ ਹਨ ਅਤੇ ਮੈਂ ਆਪਣੇ ਘਰ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਬੂਟਿਆਂ ਨਾਲ ਸਜਾਇਆ ਹੋਇਆ ਮੈਨੂੰ ਬੂਟਿਆਂ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਧੰਨਵਾਦ